ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਮੈਂ ਨਵਜੀਤ ਕੌਰ ਬੋਲ ਰਹੀ ਹਾਂ ਮੈਮ ਐਕਚੁਅਲ ਵਿੱਚ ਮੈਨੂੰ ਪਤਾ ਨਹੀਂ ਸੀ ਵੀ ਇੱਦਾਂ ਕੋਈ ਰੂਲ ਹੈਗਾ ਕਿਉਂਕਿ ਪਹਿਲਾਂ ਵੀ ਮੈਂ ਪੁਰਾਣੀ ਕਸਟਮਰ ਰਹੀ ਆ ਪਰ ਵੀ ਪਰ ਮੈਨੂੰ ਪਤਾ ਨਹੀਂ ਸੀ ਬਈ ਇਹਦਾ ਵੀ ਇੱਕ ਟਾਈਮ ਲਿਮਟ ਹੁੰਦੀ ਹੈ ਬਈ ਡੇਅਸ ਲਿਮਟ ਹੁੰਦੀ ਹੈ ਬਈ ਕਦੋਂ ਤੱਕ ਤੁਸੀਂ ਮੈਂ ਸਬਮਿਟ ਕਰਵਾ ਸਕਦੀ ਆ ਮੈਨੂੰ ਲੱਗਿਆ ਸੀ ਵੀ ਇਹ ਹੈ ਨਹੀ ਹੈਗਾ ਤਾਂ ਕਰਕੇ ਫਿਰ ਮੈਨੂੰ ਪਤਾ ਨਹੀਂ ਲੱਗਿਆ ਬਾਕੀ ਪਹਿਲਾਂ ਤਾਂ ਇਹਦਾ ਕੋਈ ਰੂਲ ਹੈ ਨਹੀਂ ਸੀ ਇਹ ਮੈਨੂੰ ਲੱਗਦਾ ਸ਼ਾਈਦ ਹੁਣੇ ਤੋਂ ਹੀ ਹੋਇਆ ਹੋਵੇਗਾ ਹਾਂਜੀ ਹਾਂਜੀ ਮੈਮ ਫਿਰ ਏ ਮੈਨੂੰ ਲੱਗਦਾ ਪਹਿਲਾਂ ਮੈਂਸ਼ਨ ਨਹੀਂ ਹੋਣਾ ਕਿਉਂਕਿ ਮੈਨੂੰ ਐਵੇਂ ਪਹਿਲਾਂ ਵੀ ਮੈਂ ਲੈ ਕੇ ਜਾ ਰਹੀ ਹਾਂ ਬੁਕਸ ਇਸ਼ੂ ਕਰਵਾਈਆਂ ਹੋਈਆਂ ਬਟ ਇੱਦਾਂ ਕੋਈ ਮੈਨੂੰ ਪਹਿਲਾਂ ਪਰੋਬਲਮ ਨਹੀਂ ਆਈ ਅਤੇ ਏਸ ਟਾਈਮ ਆਈ ਹੈ ਅਤੇ ਮੈਨੂੰ ਲੱਗਦਾ ਇਹ ਰੂਲ ਤੁਸੀਂ ਨਵਾਂ ਬਣਾਇਆ ਹੋਏਗਾ ਬਟ ਜੇ ਤੁਸੀਂ ਨਵਾਂ ਬਣਾਇਆ

ਹਾਂਜੀ ਹਾਂਜੀ ਮੈਮ ਬਟ ਇਹ ਆਈ ਥਿੰਕ ਇਹ ਤੁਹਾਡੀ ਰਿਸਪਾਂਸੀਬਿਲਟੀ ਬਣਦੀ ਹੈ ਬਈ ਤੁਸੀਂ ਜੇ ਜਦੋਂ ਮੈਂ ਬੁੱਕ ਲੈ ਕੇ ਗਈ ਸੀ ਤੁਸੀਂ ਮੈਨੂੰ ਉਦੋਂ ਦੱਸਣਾ ਸੀ ਕਿਉਂਕਿ ਹੁਣ ਇੱਦਾਂ ਤੁਸੀਂ ਹੁਣ ਮੈਨੂੰ ਫਾਈਨ ਵੀ ਪਾ ਰਹੇ ਹੋ ਫਿਰ ਇਹ ਗੱਲ ਤਾਂ ਗ਼ਲਤ ਹੈ ਨਾ ਬਈ ਪਹਿਲਾਂ ਤੁਸੀਂ ਇਨਫੋਰਮੇਸ਼ਨ ਮੈਨੂੰ ਦਿੱਤੀ ਅਤੇ ਬਾਅਦ 'ਚ ਤੁਸੀਂ ਫਾਈਨ ਵੀ ਪਾ ਰਹੇ ਹੋ ਅਤੇ ਫਿਰ ਜਾਂ ਤਾਂ ਇੱਦਾਂ ਹੋਏ ਮੈਮ ਅੱਗੇ ਤੋਂ ਮੈਂ ਆਪਦਾ ਧਿਆਨ ਰੱਖੂੰਗੀ ਬਟ ਮੈਨੂੰ ਇਸ ਵਾਰ ਫਾਈਨ ਨਾ ਫਾਈਨ ਨਾ ਲਗਾਇਆ ਜਾਵੇ ਅਤੇ ਇਹ ਚੀਜ਼ ਮੈਂ ਜ਼ਰੂਰ ਆ ਹਾਂਜੀ ਠੀਕ ਹੈ ਓਕੇ ਕੋਈ ਗੱਲ ਨਹੀਂ